ਪੇਂਡੂ ਖੇਤਰਾਂ ਵਿੱਚ ਕਿਸਾਨਾਂ ਨੂੰ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਬਦਲਦਾ ਮੌਸਮ ਤਕਨੀਕੀ ਸਹਾਇਤਾ ਕਾਫੀ ਘੱਟ ਹੈ ਅਤੇ ਛੋਟੇ ਪੱਥਰ ਦੀ ਕਿਸਾਨਾਂ ਨੂੰ ਸਹਿਲਾ ਸਹਿਲਾਈ ਅਤੇ ਕਿਸਾਨਾਂ ਕਿਸਾਨ ਕਾਫੀ ਗਰੀਬ ਹੁੰਦੇ ਨੇ ਅਤੇ ਉਹਨਾਂ ਕੋਲ ਇਨਾ ਇੰਨਾ ਪੈਸੇ ਨਹੀਂ ਹੁੰਦਾ ਕਿ ਉਹ ਕਦੇ ਕਦੇ ਕੋਈ ਟਰੈਕਟਰ ਹੀ ਖਰੀਦ ਲਈਏ ਪਰ ਟਰੈਕਟਰ ਸਾਨੂੰ ਸਭ ਤੋਂ ਟਰੈਕਟਰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿਸਾਨ ਲਈ ਅਤੇ ਬਿਨਾਂ ਟਰੈਕਟਰ ਲਈ ਉਹ ਕਿਸਾਨੀ ਕਿਵੇਂ ਕਰੇਗਾ ਅਤੇ ਗਰੀਬ ਕਿਸਾਨ ਦਾ ਇਹੀ ਹੈ ਕਿ ਸਰਕਾਰ ਨੂੰ ਗਰੀਬਾ ਗਰੀਬ ਕਿਸਾਨਾਂ ਨੂੰ ਸਬਸਿਡੀ ਪ੍ਰੋਵਾਈਡ ਕਰਨੀ ਚਾਹੀਦੀਆਂ ਨੇ ਅਤੇ ਬਿਨਾਂ ਫੰਡਿੰਗ ਦੇ ਸ ਅ ਕਿਸਾਨ ਕਿਸਾਨੀ ਕਰ ਨਹੀਂ ਸਕਦਾ ਅਤੇ ਸਾਨੇ ਅਤੇ ਸਾਡੇ ਦੇਸ਼ ਦਾ ਇੱਕ ਬਹੁਤ ਵੱਡਾ ਹਿੱਸਾ ਸਿਰਫ ਕਿਸਾਨੀ 'ਤੇ ਹੀ ਆਪਣਾ ਰਿਲਾਇਡ ਹੈ ਅਤੇ ਸਾਡੇ ਸਾਡੀ ਸਰਕਾਰ ਨੂੰ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਨਾ ਕਿ ਉਹਨਾਂ ਨੂੰ ਰੋਕਣਾ ਚਾਹੀਦਾ ਹੈ ਇੱਥੇ ਤੋਂ ਉਥੇ ਜਾਣ ਲਈ